ਪਾਣੀ ਪਾਣੀ ਹੀ ਜੀਵਨ ਹੈ ਜਿਸ ਦਾ ਅਰਥ ਹੈ ਕਿ ਜਿੱਥੇ ਪਾਣੀ ਹੈ ਉੱਥੇ ਜੀਵਨ ਹੈ ਧਰਤੀ ਉੱਤੇ ਹੀ ਸਾਰੇ ਬ੍ਰਹਿਮੰਡ ਵਿੱਚ ਪਾਣੀ ਪਾਇਆ ਗਿਆ ਪਾਣੀ ਸਾਨੂੰ ਕੁਦਰਤ ਨੇ ਦਿੱਤਾ ਇਸ ਲਈ ਸਾਨੂੰ ਇਸਦਾ ਸਤਿਕਾਰ ਕਰਨਾ ਚਾਹੀਦਾ ਨਾ ਕਿ ਇਸਦੀ ਬਰਬਾਦੀ ਪਾਣੀ ਦੀ ਵਰਤੋਂ ਮਨੁੱਖਾਂ ਜਾਨਵਰਾਂ ਪੌਦਿਆਂ ਸਭ ਦੇ ਜੀਵਨ ਵਿੱਚ ਹੁੰਦੀ ਹੈ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ ਪਾਣੀ ਹਾਈਡਰੋਜਨ ਅਤੇ ਆਕਸੀਜਨ ਦੇ ਦੋ ਅਣੂਆਂ ਨੂੰ ਮਿਲਾ ਕੇ ਬਣਦਾ ਹੈ ਪਾਣੀ ਦਾ ਰਸਾਇਣਿਕ ਫਾਰਮੂਲਾ ਐਚ ਟਵੈਂਟੀ ਹੈ ਮਨੁੱਖ ਨੂੰ ਹਮੇਸ਼ਾ ਸ਼ੁੱਧ ਅਤੇ ਸ਼ੁੱਧ ਪਾਣੀ ਪੀਣਾ ਚਾਹੀਦਾ ਪਾਣੀ ਦੀ ਇੱਕ ਬੂੰਦ ਵੀ ਬਹੁਤ ਕੀਮਤੀ ਹੈ ਜੀਵਨ ਵਿੱਚ ਪਾਣੀ ਸਿਰਫ ਪੀਣ ਲਈ ਹੀ ਲਾਭਦਾਇਕ ਨਹੀਂ ਹੈ ਸਗੋਂ ਰੋਜ਼ਾਨਾ ਜੀਵਨ ਵਿੱਚ ਵੀ ਬਹੁਤ ਲਾਭਦਾਇਕ ਹੈ ਜਿਵੇਂ ਕਿ ਨਹਾਉਣਾ ਖਾਣਾ ਬਣਾਉਣਾ ਕੱਪੜੇ ਧੋਣਾ ਸਾਫ ਕਰਨਾ ਆਦਿ ਅਜਿਹੇ ਕਈ ਕੰਮਾਂ ਲਈ ਜ਼ਰੂਰੀ ਹੈ ਪਾਣੀ ਜੀਵਨ ਹੈ